ਮੈਂ ਇੰਸਟਾਗ੍ਰਾਮ ਉੱਤੇ ਡਾਂਸ ਦੀਆਂ ਰੀਲਾਂ ਬਹੁਤ ਹੀ ਜ਼ਿਆਦਾ ਦੇਖਣਾ ਪਸੰਦ ਕਰਦੀ ਹਾਂ ਅੱਜ ਕੱਲ੍ਹ ਇਹ ਬਹੁਤ ਹੀ ਜ਼ਿਆਦਾ ਟਰੈਂਡ ਚੱਲ ਰਿਹਾ ਹੈ ਹਰ ਗਾਣੇ ਉੱਤੇ ਕੁੜੀਆਂ ਮੁੰਡੇ ਰੀਲਸ ਬਣਾ ਬਣਾ ਕੇ ਪਾਉਂਦੇ ਹਨ ਮੈਨੂੰ ਉਹਨਾਂ ਨੂੰ ਦੇਖ ਕੇ ਰੀਲਜ਼ ਬਣਾਉਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇੰਸਟਾਗ੍ਰਾਮ ਉੱਤੇ ਇੱਕ ਪੇਜ ਭੰਗੜਾ ਗਰਲਜ਼ ਦਾ ਹੈ ਜਿਸਦੀਆਂ ਰੀਲਸ ਦੇਖਣਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ